ਮੈਂ ਰਜੇਸ਼ ਕੁਮਾਰ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਪਿੰਡ ਫਿਰੋਜਪੁਰ ਕਲਾਂ ਹੈ ਜੋ ਕਿ ਸੁਜਾਨਪੁਰ ਤੋਂ ਪੰਜ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਇਹ ਪਠਾਨਕੋਟ ਜ਼ਿਲ੍ਹੇ ਵਿੱਚ ਪੈਂਦਾ ਹੈ ਮੈਂ ਇਸ ਪਿੰਡ ਵਿੱਚੋਂ ਜਦੋਂ ਅਸੀਂ ਸੁਜਾਨਪੁਰ ਤੋਂ ਪਿੰਡ ਨੂੰ ਜਾਂਦੇ ਹਾਂ ਤਾਂ ਰਸਤੇ ਵਿੱਚ ਇੱਕ ਬੜਾ ਹੀ ਇਤਿਹਾਸਿਕ ਮਹਾਨ ਮੰਦਰ ਆਉਂਦਾ ਹੈ ਜਿਸ ਨੂੰ ਲੋਕ ਬਾਗ ਵਾਲੀ ਮਾਤਾ ਜੀ ਦੇ ਨਾਮ ਨਾਲ ਜਾਣਦੇ ਹਨ ਲੋਕਾਂ ਦੀਆਂ ਸਾਰੀਆਂ ਮੰਨਤਾਂ ਉੱਥੇ ਪੂਰੀਆਂ ਹੁੰਦੀਆਂ ਹਨ ਲੋਕ ਉੱਥੇ ਜਾ ਕੇ ਦੇਵੀ ਦੇ ਦਰਸ਼ਨ ਕਰਕੇ ਮੱਥਾ ਟੇਕਦੇ ਪ੍ਰਸ਼ਾਦ ਲੈਂਦੇ ਅਤੇ ਹੋਰ ਕਈ ਤਰ੍ਹਾਂ ਦੀਆਂ ਮੰਨਤਾਂ ਨੂੰ ਕੋਈ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਉੱਥੇ ਇਹ ਦੁਆਵਾਂ ਕਰਦੇ ਹਨ ਜੋ ਕਿ ਸਾਰੀਆਂ ਹੀ ਪੂਰੀਆਂ ਹੁੰਦੀਆਂ ਹਨ ਜੈ ਮਾਤਾ ਦੀ